ਮੈਂ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਨਾ ਚਾਹੂੰਗੀ ਭੰਗੜੇ ਦੇ ਉੱਤੇ ਕੁਛ ਟਾਈਮ ਪਹਿਲਾਂ ਦੀ ਗੱਲ ਮੈਂ ਕਾਲਜ ਜੁਆਇਨ ਕੀਤਾ ਸੀਗਾ ਅਤੇ ਮੇਰਾ ਸਾਰਾ ਦਿਨ ਪੜ੍ਹਾਈ 'ਚ ਨਿਕਲਦਾ ਸੀਗਾ ਮੇਰੀ ਸਵੇਰੇ ਕਲਾਸ ਸ਼ਾਮੀ ਅਸਾਈਨਮੈਂਟ ਫਿਰ ਰਾਤੀ ਟਾਈਮ ਨਹੀਂ ਲੱਗਦਾ ਸੀ ਕੋਈ ਹੋਰ ਕੰਮ ਕਰਨ ਨੂੰ ਇਹਦੇ ਕਰਕੇ ਕੀ ਹੁੰਦਾ ਸੀ ਮੈਨੂੰ ਥਕਾਵਟ ਰਹਿਣ ਲੱਗ ਗਈ ਸੀ ਮੇਰੀ ਨੀਂਦ ਨਹੀਂ ਪੂਰੀ ਹੁੰਦੀ ਸੀਗੀ ਰਾਤੀ ਸੌਣ 'ਚ ਵੀ ਦਿੱਕਤ ਆਉਂਦੀ ਸੀਗੀ ਅਤੇ ਫਿਰ ਮੇਰੀ ਇੱਕ ਦੋਸਤ ਆ ਉਹਨੇ ਮੈਨੂੰ ਦੱਸਿਆ ਕਿ ਤੂੰ ਜਿਮ ਟਰਾਈ ਕਰ ਜਿੰਮ 'ਚ ਜਿੱਦਾਂ ਭੰਗੜਾ ਕਰਾਉਂਦੇ ਨੇ ਐਰੋਬਿਕਸ ਕਰਾਉਂਦੇ ਨੇ ਤੂੰ ਉਹ ਚੀਜ਼ ਟਰਾਈ ਕਰ ਕਿ ਇੱਕ ਤਾਂ ਤੇਰਾ ਟਾਈਮ ਵੀ ਤੇਰਾ ਘੱਟ ਲੱਗੂਗਾ ਤੇਰਾ ਮਾਈਂਡ ਵੀ ਫਰੈਸ਼ ਰਹੇਗਾ ਪਹਿਲਾਂ ਤਾਂ ਮੈਂ ਗੱਲਾਂ ਉਹਦੀਆਂ ਇਗਨੋਰ ਕੀਤੀਆਂ ਬਟ ਥੋੜ੍ਹੇ ਟਾਈਮ ਬਾਅਦ ਫਿਰ ਜਦੋਂ ਮੈਨੂੰ ਹੋਰ ਹੋਣ ਲੱਗ ਗਿਆ ਕਿ ਥਕਾਵਟ ਰਹਿੰਦੀ ਸੀ ਸਾਰਾ ਸਾਰਾ ਦਿਨ ਦਿਮਾਗ ਨਹੀਂ ਚੱਲਦਾ ਸੀਗਾ ਫਿਰ ਮੈਂ ਟਰਾਈ ਕੀਤਾ ਕਿ ਚਲੋ ਭੰਗੜਾ ਕਰਦੇ ਹੈਗੇ ਹਾਂ ਭੰਗੜਾ 'ਚ ਕੀ ਕਹਿੰਦੇ ਨੇ ਉਹਨੂੰ ਭੰਗੜਾ ਟਰਾਈ ਕਰਦੇ ਹਾਂ ਆਪਾਂ ਜਿੰਮ 'ਚ ਫਿਰ ਮੈਂ ਜਿੰਮ ਜੁਆਇਨ ਕੀਤਾ ਫਿਰ ਮੈਂ ਉੱਥੇ ਭੰਗੜਾ ਕੀਤਾ ਮੈਨੂੰ ਪਹਿਲਾਂ ਤਾਂ ਜ਼ਿਆਦਾ ਫਰਕ ਵੀ ਲੱਗਾ ਬਟ ਹੌਲੀ ਹੌਲੀ ਕਰਕੇ ਨਾ ਮੇਰਾ ਮਾਈਂਡ ਫਰੈਸ਼ ਹੋਣ ਮਤਲਬ ਮੇਰਾ ਮਾਈਂਡ ਫਰੈਸ਼ ਰਹਿੰਦਾ ਸੀਗਾ ਥਕਾਵਟ ਨਹੀਂ ਹੁੰਦੀ ਸੀ ਮੈਨੂੰ ਔਰ ਮੈਨੂੰ ਮਜ਼ਾ ਆਉਣ ਲੱਗ ਗਿਆ ਫਿਰ ਮੈਂ ਐਰੋਵਿਕਸ ਵੀ ਟਰਾਈ ਕੀਤਾ ਉਹਦੇ 'ਚ ਵੀ ਮੈਨੂੰ ਲੱਗਿਆ ਕਿ ਮੇਰੀ ਬਾਡੀ ਖੁੱਲ੍ਹ ਰਹੀ ਹੈ ਮੇਰਾ ਮਾਈਂਡ ਫਰੈਸ਼ ਰਹਿ ਰਿਹਾ ਮੇਰਾ ਮਾਈਂਡ ਪੜ੍ਹਾਈ ਨੂੰ ਛੱਡ ਕੇ ਜਾਂ ਬਾਕੀ ਕੰਮਾਂ ਨੂੰ ਛੱਡ ਕੇ ਇਸ ਚੀਜ਼ ਲੱਗ ਰਿਹਾ ਔਰ ਮੈਂ ਕਾਫੀ ਫਰਿਸ਼ ਫੀਲ ਕਰ ਰਹੀ ਹਾਂ ਅਤੇ ਸਾਨੂੰ ਭੰਗੜਾ ਵੈਸੇ ਕਰਨਾ ਚਾਹੀਦਾ ਕਿ ਸਾਡਾ ਮਾਇੰਡ ਫਰੈਸ਼ ਰਹੇ ਬੋਡੀ ਖੁੱਲ੍ਹੀ ਰਹੇ ਅਤੇ ਉਹਦੇ ਕਰਕੇ ਫਿਰ ਮੈਨੂੰ ਨੀਂਦ ਵੀ ਵਧੀਆ ਆਉਣ ਲੱਗ ਗਈ ਅਤੇ ਮੇਰੀ ਤਾਂ ਇਹੀ ਸਲਾਹ ਹੈ ਕਿ ਤੁਸੀਂ ਭੰਗੜਾ ਜ਼ਰੂਰ ਕਰੋ ਅਤੇ ਧੰਨਵਾਦ